ਦਸਤ ਲੱਗਣ ਤੇ ਘਰੇਲੂ ਨੁਖ਼ਸੇ ਆਪਾ ਦਹੀ ਵਿੱਚ ਇਸਬਗੋਲ ਪਾ ਕੇ ਪੀ ਸਕਦੇ ਹਾਂ ਕੇਲੇ ਵਿੱਚ ਮਿਕਸ ਕਰਕੇ ਦਹੀ ਖਾ ਸਕਦੇ ਹਾਂ ਅਤੇ ਚਾਹ ਵਿੱਚ ਬਰਫ਼ ਪਾ ਕੇ ਵੀ ਪੀ ਸਕਦੇ ਹਾਂ ਇਹ ਘਰੇਲੂ ਨੁਖ਼ਸੇ ਹਨ